ਅੰਮ੍ਰਿਤਸਰ ਪੰਜਾਬ ਦੇ ਸਭ ਤੋਂ ਵੱਧ ਰੌਚਕ ਅਤੇ ਅਕਸਰ ਵੇਖੇ ਜਾਣ ਵਾਲੇ ਚੋਟੀ ਦੇ ਸੈਰ ਸਪਾਟਾ ਸ਼ਹਿਰਾਂ ਵਿੱਚੋਂ ਇੱਕ ਹੈ ਸਵਾਦਲੇ ਪਕਵਾਨਾਂ ਤੋਂ ਲੈ ਕੇ ਉਹਨਾਂ ਦੇ ਹੁਸ਼ਿਆਰ ਸੱਭਿਆਚਾਰਕ ਤੱਕ ਸ਼ਹਿਰ ਇੱਕ ਰੰਗੀਨ ਸ਼ਖਸ਼ੀਅਤ ਦਾ ਮਾਣ ਕਰਦਾ ਹੈ ਜੋ ਹਰ ਸੈਲਰੀ ਹਰ ਸੈਲਾਨੀ ਨੂੰ ਘੱਟੋ ਘੱਟ ਇੱਕ ਵਾਰ ਇਸਨੂੰ ਦੇਖਣ ਲਈ ਇਸ਼ਾਰਾ ਕਰਦਾ ਹੈ ਗੋਲਡਨ ਟੈਂਪਲ ਦੇ ਸ਼ਾਂਤੀ ਅਤੇ ਸਥਾਨਕ ਲੋਕਾਂ ਦੇ ਦੋਸਤਾਨਾ ਸਵਾਗਤ ਤੋਂ ਇਲਾਵਾ ਕਲਾ ਦੇ ਸ਼ੌਕੀਨਾਂ ਲਈ ਦੇਖਣਯੋਗ ਕੁਝ ਆਰਟਗੈਲਰੀਆਂ ਹਨ ਐੱਸ ਜੀ ਠਾਕੁਰ ਆਰਟ ਗੈਲਰੀ ਅਜਿਹੀ ਹੀ ਮਾਸਟਰ ਗੈਲਰੀ ਹੈ ਇਹ ਸਿਰਫ ਇੱਕ ਆਰਟ ਗੈਲਰੀ ਤੋਂ ਵੱਧ ਹੈ ਇਸ ਵਿੱਚ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਕਲਾ ਪ੍ਰੇਮੀਆਂ ਲਈ ਇੱਕ ਸੰਸਥਾ ਹੈ ਅੰਮ੍ਰਿਤਸਰ ਅਤੇ ਪੰਜਾਬ ਵਿੱਚ ਸਭ ਤੋਂ ਪੁਰਾਣੀਆਂ ਅਤੇ ਸਭ ਤੋਂ ਮਸ਼ਹੂਰ ਆਰਟ ਗੈਲਰੀਆਂ ਵਿੱਚੋਂ ਇੱਕ ਐੱਸ ਜੀ ਠਾਕੁਰ ਆਰਟ ਗੈਲਰੀ ਹੈ ਜੋ ਕਿ ਐੱਮ ਐੱਮ ਮਾਲਵੀਆ ਰੋਡ ਇਸ ਵਿੱਚ ਇੰਡੀਅਨ ਇੰਸਟੀਟਿਊਟ ਔਫ ਫਾਈਨ ਫਾਈਨ ਆਰਟਸ ਹੈ ਅੱਜ ਕੱਲ੍ਹ ਇਸ ਆਰਟ ਗੈਲਰੀ ਵਿੱਚ ਇੱਕ ਵਿਸ਼ਾਲ ਆਡੋਟੋਰੀਅਮ ਵੀ ਹੈ ਪ੍ਰਦਰਸ਼ਨੀ ਕਲਾ ਨੂੰ ਸ਼ਾਮਿਲ ਕਰਨ ਵਾਲੀਆਂ ਗਤੀਵਿਧੀਆਂ ਨੂੰ ਉਹੀ ਵਿਚਾਰ ਪ੍ਰਾਪਤ ਹੁੰਦਾ ਹੈ ਜਿੰਨਾ ਵਿਜੂਅਲ ਆਰਟ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਆਡੀਟੋਰੀਅਮ ਦੁਆਰਾ ਸੰਗੀਤ ਨ੍ਰਿੱਤ ਥੀਏਟਰ ਅਤੇ ਸਾਹਿਤ ਦੇ ਖੇਤਰਾਂ ਵਿੱਚ ਬਹੁਤ ਸਾਰੇ ਕਲਾਤਮਕ ਪ੍ਰੋਗਰਾਮਾਂ ਦੇ ਮੇਜ਼ਬਾਨੀ ਅਤੇ ਆਯੋਜਨ ਕੀਤਾ ਗਿਆ ਸੀ ਅਕੈਡਮੀ ਨੇ ਕਲਾ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਸ ਸੰਸਥਾ ਵਿੱਚ ਚਿੱਤਰਕਾਰੀ ਮੂਰਤੀਕਾਰ ਆਦਿ ਕਲਾ ਸਿੱਖਣ ਲਈ ਪ੍ਰੇਰਿਤ ਕੀਤਾ ਹੈ ਐੱਸ ਜੀ ਠਾਕੁਰ ਸਿੰਘ ਆਰਟ ਗੈਲਰੀ ਅੰਮ੍ਰਿਤਸੋ ਅੰਮ੍ਰਿਤਸਰ ਆਉਣ ਦਾ ਸਭ ਤੋਂ ਵਧੀਆ ਸਮਾਂ ਸ ਸਭ ਤੋਂ ਵਧੀਆ ਸਮਾਂ ਬਾਰੇ ਚਰਚਾ ਕਰਦੇ ਹਾਂ ਸ਼ਹਿਰ ਦਾ ਦੌਰਾ ਕਰਨ ਦਾ ਸਭ ਤੋਂ ਵਧੀਆ ਸਮਾਂ ਅਕਤੂਬਰ ਤੋਂ ਮਾਰਚ ਦੇ ਸਰਦੀਆਂ ਦੇ ਮਹੀਨਿਆਂ ਦੌਰਾਨ ਹੁੰਦਾ ਹੈ ਤੁਸੀਂ ਠੰਡੇ ਉੱਤਰੀ ਮੌਸਮ ਬਹੁਤ ਸਾਰੇ ਤਿਉਹਾਰਾਂ ਅਤੇ ਇਸ ਦੇ ਮੂੰਹ ਵਿੱਚ ਪਾਣੀ ਭਰਨ ਵਾਲੇ ਪਕਵਾਨਾਂ ਦਾ ਆਨੰਦ ਲੈ ਸਕਦੇ ਹੋ ਜੋ ਤੁਹਾਨੂੰ ਹੋਰ ਲਈ ਵਾਪਸ ਆਉਣ ਲਈ ਇਸ਼ਾਰਾ ਕਰੇਗਾ ਸਿਖਰ ਦੀਆਂ ਗਰਮੀਆਂ ਭਾਵ ਐਪ੍ਰੈਲ ਤੋਂ ਜੂਨ ਅਤੇ ਜੁਲਾਈ ਤੋਂ ਸਤੰਬਰ ਤੱਕ ਬਰਸਾਤ ਦੇ ਮੌਸਮ ਵਿੱਚ ਯਾਤਰਾ ਕਰਨ ਤੋਂ ਪਰਹੇਜ਼ ਕਰੋ ਕਿਉਂਕਿ ਤੁਸੀਂ ਇਸ ਸ਼ਹਿਰ ਦੀ ਪੂਰੀ ਸ਼ਾਨ ਦਾ ਆਨੰਦ ਲੈਣ ਦੇ ਯੋਗ ਨਹੀਂ ਹੋਵੋਗੇ